ਖੇਡਾਂ ਨਾਲ ਸੰਬੰਧਿਤ ਕੋਈ ਹਿੱਸਾ ਮੁੜਦੇ ਜਿਵੇਂ ਚਿੜੀ ਵੱਲੇ ਵਿੱਚ ਦੋ ਹੀ ਖਿਡਾਰੀ ਹੋ ਸਕਦੇ ਹਨ ਤੀਜਾ ਕੋਈ ਖਿਡਾਰੀ ਨਹੀਂ ਹੋ ਸਕਦਾ ਇਸ ਲਈ ਕਈ ਖੇ ਕਈ ਪਿੰਡਾਂ ਵਿੱਚ ਛੋਟੇ ਖੇਤਰ ਹੁੰਦੇ ਹਨ ਕਈ ਸ਼ਹਿਰਾਂ ਵਿੱਚ ਵੱਡੇ ਖੇਤਰ ਦੇ ਨਾਲ ਹੁੰਦੇ ਹਨ ਇਸ ਕਰਕੇ ਉਹਨਾਂ ਵਿੱਚ ਖੇਡਣ ਦਾ ਬਹੁਤ ਹੀ ਆਨੰਦ ਆਉਂਦਾ ਹੈ ਖੇਡਾ ਸਾਨੂੰ ਬਚਪਨ ਤੋਂ ਹੀ ਸਿੱਖਣੀਆਂ ਚਾਹੀਦੀਆਂ ਹਨ ਖੇਡ ਸਾਨੂੰ ਸਿੱਖਣੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੇ ਦੇਸ਼ ਦਾ ਰੋਸ਼ਨ ਨਾਂ ਰੋਸ਼ਨ ਕਰ ਸਕੇਂ ਇਹ ਖੇਡ ਮੈਦਾਨ ਵਿੱਚ ਖੇਡੀ ਜਾਂਦੀ ਹੈ ਮੈਦਾਨ ਬਹੁਤ ਹੀ ਵੱਡਾ ਹੋਣਾ ਚਾਹੀਏ ਪਿੰਡਾਂ ਵਿੱਚ ਮੈਦਾਨ ਛੋਟਾ ਕਰਕੇ ਹੀ ਲੋਕ ਖੇਡਦੇ ਰਹਿੰਦੇ ਹਨ ਅਤੇ ਇਸ ਵਿੱਚ ਬਾਰ੍ਹਾਂ ਖਿਡਾਰੀ ਹੁੰਦੇ ਹਨ